ਲਿਖਣਾ ਮੇਰਾ ਸ਼ੌਕ ਹੈ ਅਤੇ ਲਿਖਣ ਦੇ ਲਈ ਪ੍ਰੇਰਨਾ ਮੈਨੂੰ ਹਰ ਚੀਜ਼ ਤੋਂ ਮਿਲਦੀ ਹੈ ਅਤੇ ਉਹਦੇ ਲਿਖਣ ਲਈ ਫੋਕਸ ਰਹਿਣ ਦੇ ਲਈ ਮੈਂ ਯੋਗਾ ਦਾ ਰੋਜ਼ ਅਭਿਆਸ ਕਰਦਾ ਹਾਂ ਲਿਖਣ ਦੇ ਲਈ ਹੁਣ ਤਾਂ ਰੋਜ਼ ਲਿਖ ਲਿਖ ਕੇ ਮੈਨੂੰ ਇੰਨਾ ਕੁ ਤਜ਼ਰਬਾ ਹੋ ਗਿਆ ਹੈ ਕਿ ਮੈਨੂੰ ਉਹਦੇ ਲਈ ਕਿਸੇ ਵੀ ਪ੍ਰੇਰਨਾ ਦੀ ਲੋੜ ਨਹੀਂ ਪੈਂਦੀ ਹੈ ਇੱਕ ਜਿਹੜੀ ਗੱਲ ਹੈ ਕਿ ਮੈਂ ਡਾਇਰੀ ਰੋਜ਼ ਜ਼ਰੂਰ ਲਿਖਦਾ ਹਾਂ ਡਾਇਰੀ ਲਿਖਣਾ ਮੇਰਾ ਸ਼ੌਕ ਰਿਹਾ ਹੈ ਬਚਪਨ ਤੋਂ ਹੀ ਮੈਨੂੰ ਡਾਇਰੀ ਲਿਖਣਾ ਬਹੁਤ ਪਸੰਦ ਹੈ ਉਹਦੇ ਵਿੱਚ ਮੈਂ ਆਪਣੇ ਰੋਜ਼ ਦੇ ਦਿਨ ਚਰਿਆ ਦੇ ਹਰ ਕੰਮ ਨੂੰ ਲਿਖਦਾ ਰਹਿੰਦਾ ਹਾਂ ਅਤੇ ਕਈ ਵਾਰ ਮਨ ਉਦਾਸ ਹੁੰਦਾ ਹੈ ਖੁਸ਼ ਹੁੰਦਾ ਹੈ ਕਈ ਵਾਰ ਹੋਰ ਵੀ ਜਿਹੜੇ ਮਨ ਦੇ ਭਾਵ ਵੀ ਹੁੰਦੇ ਨੇ ਉਹ ਵੀ ਮੈਂ ਡਾਇਰੀ ਵਿੱਚ ਰੋਜ਼ਾਨਾ ਅੰਕਿਤ ਕਰਨਾ ਪਸੰਦ ਕਰਦਾ ਹਾਂ ਅਤੇ ਆਮ ਤੌਰ ਵਿੱਚ ਪੰਜਾਬੀ ਭਾਸ਼ਾ ਨੂੰ ਹੀ ਅਸੀਂ ਯੂਸ ਕਰਦੇ ਹਾਂ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਪੰਜਾਬੀ ਨੂੰ ਹੀ ਅਸੀਂ ਰੋਜ਼ਾਨਾ ਦੀ ਭਾਸ਼ਾ ਵਿੱਚ ਯੂਸ ਕਰਦੇ ਹਾਂ ਧੰਨਵਾਦ